ਮੈਂ ਭੁਪਿੰਦਰ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਅੱਜ ਤੁਹਾਡੇ ਨਾਲ ਪੰਜਾਬੀ ਭਾਸ਼ਾ ਦੇ ਕੁਝ ਵਿਆਕਰਣ ਦੇ ਸਵਾਲਾਂ ਨੂੰ ਸਾਂਝੇ ਕਰਨਾ ਚਾਹੁੰਦਾ ਹਾਂ ਜਿਸ ਵਿੱਚ ਪਹਿਲਾ ਸਵਾਲ ਕੀ ਤੁਸੀਂ ਆਪਣੇ ਸੰਪਾਦਨਾ ਅਤੇ ਸੰਸ਼ੋਧਨ ਨੂੰ ਕਿਵੇਂ ਸੰਭਾਲਦੇ ਹੋ ਕਿ ਤੁਹਾਡੇ ਕੋਲ ਇਸ ਲਈ ਕੋਈ ਖਾਸ ਪ੍ਰਕਿਰਿਆ ਹੈ ਜਾਂ ਕੀ ਤੁਸੀਂ ਸਿਰਫ ਪਰਿਵਾਰ ਨਾਲ ਜਾਣਦੇ ਹੋ ਸੰਪਾਦਨ ਅਤੇ ਸੰਸ਼ੋਧਨ ਇੱਕ ਜਿਹਾ ਗਿਆਨਕੋਸ਼ ਹੈ ਜਿਸ ਵਿੱਚ ਕੋਈ ਵੀ ਸੰਪਾਦਨ ਜਾਂ ਸੰਸ਼ੋਧਨ ਕਰ ਸਕਦਾ ਹੈ ਸੰਪਾਦਨ ਕਰਨ ਦਾ ਕੰਮ ਬਹੁਤ ਹੀ ਸੁੱਖ ਹੈ ਅਤੇ ਇਸ ਨੂੰ ਬੜੀ ਹੀ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਜੇਕਰ ਤੁਸੀਂ ਸੰਪਾਦਕ ਜਾਂ ਸੋਤ ਕਰਨਾ ਚਾਹਣਵਾਨ ਹਾਂ ਤੇ ਇਸ ਤੇ ਅਸੀਂ ਲੇਖ ਪੜਾ ਕੇ ਵੀ ਸਪਸ਼ਟ ਕਰ ਸਕਦੇ ਹਾਂ ਜਿਸ ਵਿੱਚ ਕੋਈ ਵੀ ਨਵਾਂ ਲੇਖ ਬਣਾਉਣ ਲਈ ਸਭ ਤੋਂ ਪਹਿਲਾ ਖੋਜ ਬਖਸ਼ੇ ਦੀ ਮਦਦ ਨਾਲ ਲੇਖ ਦੀ ਉਪਲੱਬਧਤਾ ਜਾਂਚ ਕਰ ਲਵੋ ਜੇਕਰ ਲੇਖ ਪਹਿਲਾ ਹੀ ਉਪਲਬਧ ਹੁੰਦਾ ਹੈ ਤਾਂ ਤੁਸੀਂ ਇਸ ਵਿੱਚ ਸੋਧ ਕਰ ਸਕਦੇ ਹੋ ਔਰ ਜੇਕਰ ਸਿਰਲੇਖ ਦਾ ਕੋਈ ਪੰਨਾ ਉਪਲਬਧ ਨਹੀਂ ਹੈ ਤਾਂ ਖੋਜ ਨਤੀਜੇ ਵਿੱਚ ਤੁਹਾਡੇ ਦੁਆਰਾ ਦਿੱਤਾ ਸਰਲੇਖ ਲਾਲ ਰੰਗ ਦੀ ਕੜੀ ਦੇ ਰੂਪ 'ਚ ਆਵੇਗਾ ਅਤੇ ਤੁਸੀਂ ਇਸ ਨੂੰ ਸੰਸੋਧ ਕਰ ਸਕਦੇ ਹੋ ਸੰਸੋਧ ਕਰਨ ਦਾ ਇੱਕ ਹੋਰ ਤਰੀਕਾ ਹੈ ਪੁਰਾਣੇ ਪੰਨੇ ਵਿੱਚ ਸੋਧ ਕਰਕੇ ਸੰਸੋਧ ਬਣਾਉਣ ਦੇ ਨਾਲ ਨਾਲ ਪਹਿਲਾਂ ਤੋਂ ਬਣੇ ਲੇਖ ਵਿੱਚ ਵੀ ਵਾਧਾ ਕਰ ਸਕਦੇ ਹੋ ਇਸ ਬਹੁਤ ਹੀ ਅਸਾਂ ਹੈ ਜਦੋਂ ਤੁਸੀਂ ਕਿਸੇ ਵੀ ਲੇਖ ਤੇ ਪਹੁੰਚਦੇ ਹੋ ਤਾਂ ਉਸ ਸਫੇ ਦੇ ਬਿਲਕੁਲ ਉੱਪਰੋ ਦੂਸਰੇ ਬਾਰੇ ਸੋਧ ਇਸਦੇ ਨਾਲ ਹੀ ਲਿਖਿਆ ਹੋਵੇਗਾ ਲਿਖਿਆ ਹੋਵੇਗਾ ਤੁਸੀਂ ਸੋਧ ਦੇ ਕਲਿਕ ਕਰਨਾ ਹੈ ਜੇਕਰ ਤੁਸੀਂ ਕਿਸੇ ਲੇਖ ਦਾ ਕੋਈ ਖਾਸ ਪੈਰਾ ਸੁਲਤਾਨਾ ਚਾਹੁੰਦੇ ਹੋ ਤਾਂ ਉਸ ਪੈਰੇ ਨਾਲ ਜਰੂਰ ਜੁੜੋ